ਪੰਜਾਬ ਨੂੰ ਰੰਗਲਾ ਪੰਜਾਬ ਇੱਥੋਂ ਦੇ ਮੇਲਿਆਂ ਅਤੇ ਤਿਉਹਾਰਾਂ ਕਰਕੇ ਵੀ ਕਿਹਾ ਜਾਂਦਾ ਹੈ ਸੰਦਾ ਪੰਜਾਬ ਦੇ ਕੁਝ ਪ੍ਰਸਿੱਧ ਤਿਉਹਾਰ ਹਨ ਦਿਵਾਲੀ ਲੋਹੜੀ ਵਿਸਾਖੀ ਇਸ ਤੋਂ ਇਲਾਵਾ ਮੇਲੇ ਬਹੁਤ ਤਰ੍ਹਾਂ ਦੇ ਹੁੰਦੇ ਹਨ ਵਿਸਾਖੀ ਦਾ ਮੇਲਾ ਤੀਆਂ ਦਾ ਮੇਲਾ ਅਤੇ ਨੌਮੀ ਦਾ ਮੇਲਾ ਅੱਜ ਮੈਂ ਕਰਦਾ ਗੱਲ ਨੌਮੀ ਦੇ ਮੇਲੇ ਦੀ ਪਿੰਡਾਂ ਵਿੱਚ ਨੌਮੀ ਦਾ ਮੇਲਾ ਸ਼੍ਰੀ ਗੁੱਗਾ ਨੌਮੀ ਜੀ ਦੇ ਜੋ ਗੁੱਗਾ ਮਾੜੀ ਜੀ ਨੇ ਗੁੱਗਾ ਜੀ ਦੇ ਬਰਥ ਬਰਥ ਬਰਥਡੇਅ ਕਰਕੇ ਮਨਾਇਆ ਜਾਂਦਾ ਹੈ ਇਸ ਦਿਨ ਗੁੱਗਾ ਜੀ ਦੇ ਮੰਦਰ ਵਿੱਚ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਨੂੰ ਮੱਥਾ ਟੇਕਦੇ ਨੇ ਇਸ ਤੋਂ ਇਲਾਵਾ ਉਹ ਇਸ ਤੋਂ ਇਲਾਵਾ ਤੀਆਂ ਦਾ ਮੇਲਾ ਹੁੰਦਾ ਹੈ ਤੀਆਂ ਦਾ ਮੇਲਾ ਬੇਸਿਕਲੀ ਤਾਂ ਕੁੜੀਆਂ ਲਈ ਹੁੰਦਾ ਔਰ ਕੁੜੀਆਂ ਕਿਸੇ ਵੀ ਪਿੰਡ ਦੇ ਮੇਨ ਚੌਂਕ ਜਾਂ ਧਰਮਸ਼ਾਲਾ ਵਿੱਚ ਇਕੱਠੀਆਂ ਹੁੰਦੀਆਂ ਨੇ ਅਤੇ ਉੱਥੇ ਖਾਣ ਪੀਣ ਦੀਆਂ ਸਟਰੋਲਜ ਵੀ ਲੱਗੀਆਂ ਹੁੰਦੀਆਂ ਨੇ ਖਾਣ ਪੀਣਾ ਇੰਜੋਏ ਕਰਦੀਆਂ ਅਤੇ ਪੀਘਾਂ ਝੂਟਦੀਆਂ ਨੇ